ਸਤਿ ਸ਼੍ਰੀ ਅਕਾਲ ਜੀ ਜੀ ਹਰਮਨਜ ਰੈਸਟੋਰੈਂਟ ਤੋਂ ਗੱਲ ਕਰ ਰਹੇ ਹੋ ਜੀ ਮੈਂ ਅਭਿਸ਼ੇਕ ਗੱਲ ਕਰ ਰਿਹਾ ਮਾਨਸਾ ਤੋਂ ਜੀ ਮੈਂ ਤੁਹਾਡੇ ਰੈਸਟੋਰੈਂਟ ਦਾ ਸਮਾਂ ਪੁੱਛਣਾ ਸੀ ਜੀ ਕਦੋਂ ਖੁੱਲ੍ਹਦਾ ਹੈ ਜੀ ਜੀ ਜੀ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਘੁੰਮਣ ਫਿਰਨ ਆਉਣਾ ਸੀ ਤਾਂ ਅਸੀਂ ਹੁਣੇ ਹੀ ਚੱਲੇ ਹਾਂ ਇੱਧਰੋਂ ਸਾਢੇ ਕੁ ਦਸ ਤਾਈਂ ਪਹੁੰਚਣਗੇ ਖੁੱਲ੍ਹਾ ਹੋਵੇਗਾ ਉਹ ਜਦੋਂ ਤਾਈਂ ਅੱਛਾ ਅੱਛਾ ਗਿਆਰ੍ਹਾਂ ਵਜੇ ਤਾਈਂ ਖੁੱਲ੍ਹਾ ਰਹਿੰਦੇ ਹਾਂ ਅਸੀਂ ਸਾਢੇ ਕੁ ਦਸ ਤੱਕ ਪਹੁੰਚ ਜਾਣਗੇ ਅਤੇ ਤੁਸੀਂ ਮੈਨੂੰ ਟੇਬਲ ਦੀ ਉਪਲੱਬਧਤਾ ਬਾਰੇ ਵੀ ਦੱਸ ਦਿਓ ਜੇ ਹੋਵੇਗੀ ਤਾਂ ਫਿਰ ਇੱਕ ਟੇਬਲ ਵੀ ਬੁੱਕ ਕਰ ਦਿਓ ਜੀ ਅਸੀਂ ਪੰਜ ਜਣੇ ਹੈਗੇ ਹਾਂ ਇੱਕ ਟੇਬਲ ਬੁੱਕ ਕਰ ਦਿਓ ਅਤੇ ਅਸੀਂ ਗੱਡੀ 'ਤੇ ਆਉਣਾ ਹੈ ਕੀ ਆਪਣੇ ਇੱਥੇ ਪਾਰਕਿੰਗ ਦੀ ਸੁਵਿਧਾ ਹੈਗੀ ਆ ਅੱਛਾ ਅੱਛਾ ਹੈਗੀ ਹੈ ਹੈਗੀ ਹੈ ਚੰਗਾ ਜੀ ਚੰਗਾ ਚੰਗਾ ਧੰਨਵਾਦ ਜੀ